ਮੈਂ ਇੱਕ ਨਵੀਂ ਘੜੀ ਖਰੀਦਣ ਜਾ ਰਿਹਾ ਅਤੇ ਇਸ ਵਿੱਚ ਮੈਂ ਐਪਲ ਕੰਪਨੀ ਦੀ ਇੱਕ ਵਾਚ ਖਰੀਦਣੀ ਚਾਹੁੰਦਾ ਗਾ ਜਿਹੜੀ ਕਿ ਐਮਾਜ਼ਾਨ ਉੱਪਰ ਉਪਲਬਧ ਹੈ ਬਿਗ ਬਿਲੀਅਨ ਡੇ ਸੇਲ ਚੱਲ ਰਹੀ ਹੈ ਅਤੇ ਮੇਰੇ ਕੋਲ ਕੁਝ ਕੂਪਨ ਕੋਡ ਵੀ ਪਏ ਹਨ ਕਿਉਂਕਿ ਮੈਂ ਅਕਸਰ ਉੱਥੋਂ ਸ਼ੋਪਿੰਗ ਕਰਦਾ ਰਹਿੰਦਾ ਗਾ ਅਤੇ ਮੈਂ ਐਪਲ ਦੀ ਇੱਕ ਘੜੀ ਦੇਖੀ ਸੀਰੀਜ਼ ਥਰੀ ਦੀ ਜੋ ਕਿ ਮੈਨੂੰ ਬਹੁਤ ਪਸੰਦ ਆਈ ਅਤੇ ਮੈਨੂੰ ਕਾਫੀ ਸਮੇਂ ਤੋਂ ਉਸਦੀ ਲੋੜ ਵੀ ਸੀ ਜਿਹਦੇ ਵਿੱਚ ਮੈਨੂੰ ਇੱਕ ਅ ਤਿੰਨ ਰਬੜ ਸਟੈਪਸ ਸਟਰੈਪਸ ਮਿਲ ਰਹੇ ਹਨ ਫਰੀ ਅਤੇ ਜੀ ਪੀ ਐਸ ਵੀ ਹੈ ਜੀ ਐਮ ਐਸ ਵੀ ਹੈ ਅਤੇ ਹਾਰਟ ਬੀਟ ਟਰੈਕਰ ਵਗੈਰਾ ਇਹਦੇ 'ਚ ਬਹੁਤ ਸਾਰੇ ਫੰਕਸ਼ਨ ਨੇ ਮੈਂ ਅ ਮੈਂ ਐਕਸਪਲੇਨ ਨਹੀਂ ਕਰ ਸਕਦਾ ਇੱਥੇ ਕਿਉਂਕਿ ਸਮਾਂ ਬਹੁਤ ਥੋੜ੍ਹਾ ਗਾ ਅਤੇ ਇਸ ਤੋਂ ਬਾਅਦ ਜਦੋਂ ਉਸਦੀ ਕੀਮਤ ਆ ਰਹੀ ਹੈ ਤਾਂ ਕੀਮਤ ਮੈਨੂੰ ਉਹਦੀ ਚੁਕਾ ਰਹੀ ਹੈ ਕਿਉਂਕਿ ਕੀਮਤ ਉਸਦੀ ਹੈ ਅਠਾਰਾਂ ਹਜ਼ਾਰ ਰੁਪਏ ਸੋ ਮੈਨੂੰ ਚੀਜ਼ ਪਸੰਦ ਵੀ ਹੈ ਮੈਂ ਖਰੀਦਣਾ ਵੀ ਚਾਹੁੰਦਾ ਗਾ ਪਰ ਅਠਾਰਾਂ ਹਜ਼ਾਰ ਰੁਪਏ ਕੀਮਤ ਜਿਹੜੀ ਅਦਾ ਕਰਨੀ ਬਹੁਤ ਹੀ ਔਖੀ ਹੈ ਇਕਦਮ ਤਾਂ ਮੈਂ ਕੀ ਕੀਤਾ ਮੇਰੇ ਕੋਲ ਕੁਝ ਕੂਪਨ ਕੋਡ ਪਏ ਸੀ ਅਤੇ ਮੇਰੇ ਕੋਲ ਇੱਕ ਪ੍ਰੋਮੋ ਕੋਡ ਵੀ ਹੈ ਅਤੇ ਮੈਂ ਉਹ ਕੁਪਨ ਕੋਡ ਅਪਲਾਈ ਕੀਤੇ ਕੁਝ ਜ਼ਿਆਦਾ ਫਰਕ ਨਹੀਂ ਪਿਆ ਅਤੇ ਉਸ ਤੋਂ ਬਾਅਦ ਅ ਮੈਂ ਆਪਣਾ ਜਿਹੜਾ ਪ੍ਰੋਮੋ ਕੋਡ ਆ ਉਸਨੂੰ ਯੂਜ਼ ਕੀਤਾ ਪ੍ਰੋਮੋ ਕੋਡ ਯੂਜ਼ ਕਰਨ ਤੋਂ ਬਾਅਦ ਮੈਂ ਕੀ ਦੇਖਿਆ ਕਿ ਉਸ ਵਿੱਚੋਂ ਮੈਨੂੰ ਤਿੰਨ ਹਜ਼ਾਰ ਰੁਪਏ ਦੀ ਜਿਹੜੀ ਛੂਟ ਹੈ ਉਹ ਮਿਲ ਰਹੀ ਹੈ ਮੈਂ ਇਹ ਦੇਖ ਕੇ ਬਹੁਤ ਅ ਖੁਸ਼ੀ ਸੀਗਾ ਖੁਸ਼ ਸੀਗਾ ਵੀ ਮੈਂ ਮੈਨੂੰ ਤਿੰਨ ਹਜ਼ਾਰ ਰੁਪਏ ਛੂਟ ਮਿਲ ਰਹੀ ਹੈ ਅਤੇ ਜਿਹੜੀ ਇਸ ਘੜੀ ਦੀ ਜਿਹੜੀ ਕੀਮਤ ਹੈ ਉਹ ਹੁਣ ਸਿਰਫ ਪੰਦਰਾਂ ਹਜ਼ਾਰ ਰੁਪਏ ਰਹਿ ਗਈ ਹੈ ਤਾਂ ਮੈਂ ਇਸ ਨੂੰ ਜਲਦੀ ਤੋਂ ਜਲਦੀ ਜਿਹੜੀ ਅ ਖਰੀਦਣ ਦੀ ਸੋਚੀ ਇਹ ਕਿਉਂਕਿ ਆਊਟ ਆਫ ਸਟੋਕ ਨਾ ਹੋ ਜਾਵੇ ਇਹ ਵੀ ਚਿੰਤਾ ਰਹਿੰਦੀ ਹੈ ਕਿਉਂਕਿ ਜਦੋਂ ਸੇਲ ਲੱਗੀ ਹੁੰਦੀ ਹੈ ਅਤੇ ਤੁਹਾਡੇ ਕੋਲ ਪ੍ਰੋਮੋ ਕੋਡ ਹੁੰਦੇ ਹਨ ਤਾਂ ਆਊਟ ਆਫ ਸਟੋਕ ਹੋਣ ਦਾ ਡਰ ਹੁੰਦਾ ਤਾਂ ਮੈਂ ਜਲਦੀ ਜਲਦੀ ਉਸ ਨੂੰ ਚੈੱਕ ਆਉਟ ਕੀਤਾ ਆਪਣਾ ਨਾਮ ਪਤਾ ਅਤੇ ਫੋਨ ਨੰਬਰ ਅਤੇ ਹੋਰ ਜਾਣਕਾਰੀ ਜਿਹੜੀ ਮੈਂ ਫਿੱਲ ਕੀਤੀ ਅਤੇ ਜਿਹੜੀ ਇਸ ਦੀ ਅਦਾਇਗੀ ਹੈ ਜਿਹੜੀ ਦੀ ਪੇਮੈਂਟ ਹੈ ਉਹ ਮੈਂ ਅਡਵਾਂਸ ਵਿੱਚ ਹੀ ਕਰ ਦਿੱਤੀ